ਹੈਲੋ ਹਾਂਜੀ ਅੱਛਾ ਅੱਛਾ ਹੋਰ ਕਿੱਦਾਂ ਅੱਛਾ ਉਹੀ ਜਿੱਥੇ ਮਿਲੇ ਸੀ ਆਪਾਂ ਨਵੇਂ ਨਵੇਂ ਆਏ ਹੋ ਹਾਂ ਹਾਂਜੀ ਹੋਰ ਦੱਸੋ ਕਿੱਦਾਂ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਮੈਂ ਬਸ ਬੈਠਾ ਵੈਸੇ ਘਰ ਹੋਰ ਕੀ ਕਰਨਾ ਜੀ ਤੁਹਾਨੂੰ ਪਤਾ ਹੀ ਆ ਤੁਹਾਨੂੰ ਪੀਜੀ ਮਿਲ ਗਿਆ ਸੀ ਅੱਛਾ ਹੁਸ਼ਿਆਰਪੁਰ ਘੁੰਮਣਾ ਸੀ ਅੱਛਾ ਹੁਸ਼ਿਆਰਪੁਰ ਵੈਸੇ ਤਾਂ ਘੁੰਮਣ ਜਾਣਾ ਹਾਂ ਤੁਹਾਡੇ ਤੁਹਾਡੇ ਨਾਲ ਸਾਡੇ ਦੋ ਤਿੰਨ ਦੋਸਤ ਵੀ ਆਏ ਹੋਣੇ ਉਹਨੇ ਵੀ ਜਾਣਾ ਨਾਲ ਘੁੰਮਣ ਤੁਹਾਡੇ ਹੁਸ਼ਿਆਰਪੁਰ ਤੁਸੀਂ ਘੁੰਮਣ ਜਾ ਸਕਦੇ ਸੀ ਹੁਸ਼ਿਆਰਪੁਰ ਤੁਸੀਂ ਨਾਲਾ ਡੈਮ ਜਾ ਸਕਦੇ ਹੋ ਹੁਸ਼ਿਆਰਪੁਰ ਘੁੰਮਣ ਦੇਖੋ ਤੁਸੀਂ ਜਾ ਸਕਦੇ ਹੋ ਨਾਲਾ ਡੈਮ ਨਾਲਾ ਡੈਮ ਤੁਸੀਂ ਵੈਸੇ ਚੌਹਾਲ ਵੱਲ ਨੂੰ ਜਾ ਸਕਦੇ ਹੋ ਤੁਸੀਂ ਚੌਹਾਨ ਵੱਲ ਜਾ ਸਕਦੇ ਤੁਸੀਂ ਜਾ ਸਕਦੇ ਹੋ ਅਤੇ ਤੁਸੀਂ ਨਹੀਂ ਕੈਬ ਦੀ ਤਾਂ ਲੋੜ ਹੀ ਨਹੀਂ ਕੋਈ ਇਹਨਾਂ ਨਹੀਂ ਅਤੇ ਸਰਵਨੰਦ ਕਾਲਜ ਦੀ ਪੀਜੀ ਤੋਂ ਬਾਹਰ ਨਿਕਲੂਗੇ ਨਾ ਤੁਹਾਨੂੰ ਆਟੋ ਮਿਲ ਜਾਣਾ ਜਾਂ ਕੋਈ ਪਬਲਿਕ ਪਬਲਿਕ ਔਟੋ ਚਲਦੇ ਇੱਥੇ ਤੁਹਾਨੂੰ ਆਟੋ ਮਿਲ ਜਾਣਾ ਕੋਈ ਆਟੋ ਮਨੇ ਵੀਹ ਰੁਪਏ ਸਵਾਰੀ ਲੈਣੀ ਹੈ ਅਗਰ ਜ਼ਿਆਦਾ ਮੰਗੇ ਤੁਸੀਂ ਫਿਰ ਇਹ ਕਹਿਣਾ ਆਪਾਂ ਲੋਕਲ ਹੀ ਆ ਸਾਨੂੰ ਪਤਾ ਕਿੰਨਾ ਹਿਸਾਬ ਕੀ ਕੀ ਆ ਮੰਗ ਲੈਂਦੇ ਕਈ ਜ਼ਿਆਦਾ ਤੁਸੀਂ ਕਹਿੰਦੇ ਸਾਨੂੰ ਪਤਾ ਬੱਸ ਨਹੀਂ ਜਾਣਾ ਠੀਕ ਆ ਤੁਸੀਂ ਇੰਨਾਂ ਕਹਿਣਾ ਕਿ ਆਟੋ ਫੜਨਾ ਬੱਸ ਜਾਣਾ ਆਟੋ ਨਹੀਂ ਮਿਲਦਾ ਇੱਥੇ ਬੱਸਾਂ ਵੀ ਆਉਂਦੀਂਆਂ ਰਹਿੰਦੀਆਂ ਪੰਜ ਮਿੰਟ ਬਾਅਦ ਇੱਥੇ ਬੱਸ ਗਵਰਮੈਂਟ ਕਰਦੀਆਂ ਨੇ ਪਬਲਿਕ ਵਾਸਤੇ ਪਬਲਿਕ ਵਾਸਤੇ ਟਿਕਟ ਦਾ ਕ ਟਿਕਟ ਮਿਲਣੀ ਹੈ ਹੁਣ ਗਾਇਆ ਸਾਨੂੰ ਬੱਸ ਸਟੈਂਡ ਛੱਡ ਦੇ ਬੱਸ ਸਟੈਂਡ ਉੱਤੇ ਨਾ ਬੱਸ ਸਟੈਂਡ ਤੋਂ ਬਾਅਦ ਵੀ ਇੱਥੇ ਘੁਮਿਆਲ ਵੱਲ ਨੂੰ ਜਾਣਾ ਬੱਸ ਸਟੈਂਡ ਉਤਰਨਾ ਨਾ ਬੱਸ ਸਟੈਂਡ ਤੋਂ ਬਾਅਦ ਤੁਸੀਂ ਜਿੱਥੇ ਘੁੰਮਿਆ ਜਾਂਦਾ ਚੌਹਾਲ ਵੱਲ ਨੂੰ ਜਾਣਾ ਜਾਣਾ ਬਸ ਸਟੈਂਡ 'ਚ ਬਹਿਣਾ ਪਬਲਿਕ ਬਸ ਕਹਿਣਾ ਸਾਨੂੰ ਚੋਹਾਲ ਲੈ ਚਲੀ ਜਾਣਾ ਆਪਾਂ ਹੁਣ ਸਾਨੂੰ ਲੈ ਜਾਣਾ ਤੁਹਾਨੂੰ ਲੈ ਜਾਣਾ ਹੁਣ ਸਾਨੂੰ ਲੈ ਜਾਣਾ ਤੁਹਾਨੂੰ ਲੈ ਜਾਣਾ ਰਨ ਬਸ ਤੈਨੂੰ ਬਸ ਤਾਂ ਇਲੈਕਟਰਿਕ ਰਿਕਸ਼ਾ ਵੀ ਚਲਦੇ ਰਹਿੰਦੇ ਆ ਤਕਲੀਫ ਤਾਂ ਹੋਣੀ ਨਹੀਂ ਪਬਲਿਕ ਟ੍ਰਾਂਸਪੋਰਟ ਬਹੁਤ ਫਸਿਲਟੀਜ਼ ਆ ਇੱਥੇ ਪਬਲਿਕ ਦੀ ਬੱਸਾਂ ਚਲਦੀਆਂ ਰਹਿੰਦੀਆਂ ਨੇ ਪੰਜ ਮਿੰਟ ਬਾਅਦ ਬੱਸਾਂ ਨੇ ਜਿੱਥੇ ਮਰਜ਼ੀ ਲੈ ਜਾਣਾ ਜੇ ਤੁਸੀਂ ਕਹੋਂਗੇ ਵੈਸੇ ਤੇ ਜ਼ਿਆਦਾ ਟਿਕਟ ਦਾ ਕਿਰਾਇਆ ਵੀ ਲੱਗਣਾ ਆਪਣੇ ਵਹੀਕਲ ਦਾ ਵੈਸ ਆਟੋ ਤਾਂ ਆਟੋ ਵਾਲੇ ਨੇ ਲੈਣੇ ਤੁਹਾਨੂੰ ਆਟੋ ਨੇ ਇਹ ਕਿ ਕਿਰਾਇਆ ਜ਼ਿਆਦਾ ਲੈਣਾ ਬੱਸਾਂ ਦਾ ਇਹ ਹੈ ਕਿ ਕਿਰਾਇਆ ਘੱਟ ਜਾਣਾ ਤੁਹਾਡਾ ਬੱਸਾਂ ਸਸਤੀ ਪੈਣੀ ਥੋੜ੍ਹੀ ਸਰਕਾਰੀ ਬੱਸਾਂ ਤੁਹਾਨੂੰ ਪਤਾ ਸਸਤੀ ਪੈਣੀ ਥੋੜ੍ਹੀ ਪ੍ਰਾਈਵੇਟ ਤੁਹਾਨੂੰ ਪਤਾ ਮਹਿੰਗੀ ਪੈਣੀ ਪਬਲਿਕ ਟਰਾਂਸਪੋਰਟ ਚਲਦੀ ਅੱਜ ਕੱਲ੍ਹ ਪਬਲਿਕ ਟਰਾਂਸਪੋਰਟ ਬਹੁਤ ਚਲਦੀ ਪਈ ਸਹਾਰਨਪੁਰ ਵਿੱਚ ਪਬਲਿਕ ਟਰਾਂਸਪੋਰਟ ਦੀ ਸਥਿਤੀ ਬਹੁਤ ਵਧੀਆ ਸ਼ਾਮ ਵਧੀਆ ਤੁਸੀਂ ਤਾਂ ਸੇਫ ਹੋਣਗੇ ਇੱਕ ਤੁਹਾਨੂੰ ਲੋੜ ਨਹੀਂ ਪਉਂਗੀ ਤੁਸੀਂ ਜਾਣਾ ਆਪਣੇ ਸੈਵਨ ਕਾਲਜ ਤੋਂ ਨਿਕਲਣਾ ਅਤੇ ਮਤਲਬ ਆਟੋ ਫਨੀ ਆਟੋ ਨਹੀਂ ਮਿਲੇ ਤਾਂ ਬਸ ਫਨੀ ਬਸ ਫੜ ਕੇ ਬੱਸ ਸਟੈਂਡ ਜਾਣਾ ਬੱਸ ਸਟੈਂਡ ਤੋਂ ਬਾਅਦ ਤੁਸੀਂ ਜਾਣਾ ਚੌਹਾਲ ਵੱਲ ਨੂੰ ਜਿੱਥੇ ਘੁੰਮਣ ਜਾਣਾ ਤੁਸੀਂ ਹੁਣ ਕਹਿ ਦੇ ਚੋਹਾਲ ਦਾ ਸੀ ਨਾਲਾ ਡੈਮ ਨਾਲਾ ਡੈਮ ਬਾਰੇ ਸਰ ਕਾਲਜ ਦੇ ਕੋਲ ਹੀ ਆ ਨਾਲਾ ਡੈਮ ਤੁਸੀਂ ਸਰ ਕਾਲਜ ਦੇ ਬਾਹਰ ਜਾਣਾ ਸਰ ਕਾਲਜ ਤੁਸੀਂ ਆਪ ਬਸ ਵਾਲੇ ਨੂੰ ਕਹਿਣਾ ਕਿਸੇ ਨੂੰ ਰਸਤੇ 'ਚ ਨਾਲਾ ਡੈਮ ਦੀ ਬਸ ਉਹਨਾਂ ਨੂੰ ਛੱਡ ਦੇਣਾ ਕੋਈ ਅੱਜ ਕੱਲ੍ਹ ਨਾ ਸਰਕਾਰੀ ਵੈਸੇ ਚੱਲਦੀ ਰਹਿੰਦੀਆ ਦਸ ਦਸ ਮਿੰਟ ਬਾਅਦ ਵੀਹ ਵੀਹ ਮਿੰਟ ਬਾਅਦ ਚਲਦੀ ਆ ਤੁਹਾਨੂੰ ਮਿਲ ਜਾਣੀ ਆਰਾਮ ਨਾਲ ਬਸ ਕੋਈ ਉਹਨੇ ਬਿਠਾਉਣਾ ਅਤੇ ਛੱਡ ਦੇਣਾ ਜਿਹੜੀ ਮੈਂ ਸਰਕਾਰੀ ਅਤੇ ਅਤੇ ਜਿਹੜੀ ਬੱਸ ਸਰ ਕਾਲਜ ਤੁਹਾਡੇ ਪਾਸੇ ਵੱਲ ਨੂੰ ਜਾ ਰਹੀ ਨਾ ਉਹ ਲੈਣੀ ਉਹ ਵਾਲੀ ਲੈ ਲਿਓ ਤੁਹਾਨੂੰ ਸਹੀ ਰਹਿਣਾ ਸਾਰਾ ਕੁਛ ਬਾਕੀ ਇੰਨਾਂ ਤਕਲੀਫ ਨਹੀਂ ਹੋਣੀ ਆਟੋਮੇਸ਼ਨ ਦਾ ਚਲਦੀ ਬੱਸਾਂ ਵੀ ਬਾਕੀ ਘੁੰਮਣ ਦੀ ਜਗ੍ਹਾ ਤਾਂ ਇਹੀ ਆ ਕਿ ਖਾਣ ਪੀਣ ਨੂੰ ਮਿਲ ਜਾਣਾ ਵਧੀਆ ਜਗ੍ਹਾ 'ਤੇ ਘੰਟਾ ਘਰ ਘੁੰਮਣਾ ਤੁਸੀਂ ਆਟ ਬਸ ਸਟੈਂਡ ਬਸ ਲਈਓ ਬੱਸ ਤੋਂ ਉਤਰੀਓ ਘੰਟਾ ਕਾ ਆਟੋ ਖੜ੍ਹੀ ਹੋ ਆਟੋ ਘੰਟਾ ਕੋ ਮਾਰਕੀਟ ਦੇਖੇ ਸਾਰਾ ਕੁ ਟੈਂਸ਼ਨ ਲੋਡ ਹੀ ਨਹੀਂ ਬਾਕੀ ਨਹੀਂ ਹੋਇਆ ਮੈਨੂੰ ਫੋਨ ਕਰ ਦਿਓ ਮੈਂ ਆ ਜਾਊਂਗਾ ਇੰਨਾਂ ਕੁਝ ਨਹੀਂ ਹੈ ਚਲੋ ਕੋਈ ਨਹੀਂ ਅਬ ਆ ਕੋਈ ਨਹੀਂ ਅਗਰ ਤੁਹਾਨੂੰ ਲੋੜ ਪਈ ਤਾਂ ਫੋਨ ਕਰ ਲਿਓ ਕੋਈ ਹਾਂਜੀ ਕੋਈ ਨਹੀਂ ਕੋਈ ਨਹੀਂ ਇਹ ਤਾਂ ਆਪਣੀ ਗੱਲ ਹੀ ਦੋਸਤਾਂ ਦੀ ਗੱਲ ਹੈ ਠੀਕ ਹੈ ਜੀ ਠੀਕ ਠੀਕ ਹੈ ਜੀ ਓਕੇ ਜੀ ਬਾਏ ਬਾਏ